ਤਕਨਾਲੋਜੀ ਨੇ ਮੇਰੇ ਦੋਸਤਾਂ ਅਤੇ ਪਰਿਵਾਰ ਨਾਲ ਸੰਚਾਰ ਕਰਨ ਦੇ ਤਰੀਕਿਆਂ ਨੂੰ ਬਹੁਤ ਵੱਡੇ ਪੈਮਾਨੇ 'ਤੇ ਬਦਲ ਦਿੱਤਾ ਹੈ ਸ਼ੋਸ਼ਲ ਮੀਡੀਆ ਪਲੇਟਫੋਰਮਜ ਮੈਸੇਜਨਿੰਗ ਐਪਸ ਵੀਡੀਓ ਕਾਲਿੰਗ ਵਟਸਅਪ ਫੇਸਬੁੱਕ ਨੇ ਜ਼ਿਆਦਾ ਸਹਿਜੇ ਢੰਗ ਨਾਲ ਜੁੜੇ ਰਹਿਣ ਦਾ ਮੌਕਾ ਦਿੱਤਾ ਹੈ ਸਾਡੇ ਵਿਚਾਰਾਂ ਤਜ਼ਰਬਿਆਂ ਅਤੇ ਦਿਨਚਰਿਆ ਦੇ ਹਾਲਾਤ ਤੁਰੰਤ ਸਾਂਝੇ ਕਰਨ ਨਾਲ ਸਾਡੇ ਸੰਪਰਕ ਨੇ ਇੱਕ ਨਵਾਂ ਅੰਜਾਮ ਲਿਆ ਹੈ ਜਿਸ ਨਾਲ ਵਿਦੇਸ਼ੀ ਸਥਿਤੀਆਂ ਦੇ ਬਾਵਜੂਦ ਅਸੀਂ ਇੱਕ ਦੂਜੇ ਨਾਲ ਨਿਯਮਿਤ ਤੌਰ 'ਤੇ ਜੁੜੇ ਰਹਿ ਸਕਦੇ ਹਾਂ ਇਸ ਤਕਨੀਕੀ ਤਰੱਕੀ ਦੇ ਨਾਲ ਵੀਡੀਓ ਕਾਲਾਂ ਟੈਕਸਟ ਮੈਸੇਜ ਨੇ ਸਾਡੀ ਯਾਦਗਰਾਂ ਅਤੇ ਖੁਸ਼ੀਆਂ ਨੂੰ ਸਾਂਝਾ ਕਰਨ ਨੂੰ ਅਸਾਨ ਬਣਾਇਆ ਹੈ ਪਰ ਕਈ ਵਾਰ ਇਸ ਵਿਰੋਧ ਵਿੱਚ ਔਨਲਾਈਨ ਸੰਚਾਰ ਦੀ ਘਾਟ ਪੈਦਾ ਹੋ ਜਾਂਦੀ ਹੈ ਜਿਵੇਂ ਕਿ ਸਰੀਰਕ ਮੌਜੂਦਗੀ ਅੱਜ ਸਿੱਧਾ ਮੀਟਿੰਗ ਦੀ ਘਾਟ ਮੈਂ ਮਹਿਸੂਸ ਕਰਦਾ ਹਾਂ ਕਿ ਤਕਨਾਲੋਜੀ ਨੇ ਮੇਰੇ ਰਿਸ਼ਤੇ ਨੂੰ ਆਮੂਨ ਮਜ਼ਬੂਤ ਕੀਤਾ ਹੈ ਕਿਉਂਕਿ ਇਸ ਨੇ ਸੰਪਰਕ ਨੂੰ ਨਿਯਮਿਤ ਅਤੇ ਸਹਿਜ ਬਣਾਇਆ ਹੈ ਪਰ ਕਈ ਵਾਰ ਇਹ ਗਹਿਰੇ ਅਤੇ ਪ੍ਰਤੀਤ ਰਿਸ਼ਤਿਆਂ ਨੂੰ ਪ੍ਰਭਾਵਿਤ ਵੀ ਕਰ ਸਕਦੀ ਹੈ ਜਿੱਥੇ ਸਰੀਰਕ ਮੌਜੂਦਗੀ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉੱਥੇ ਇਹ ਤਕਨਾਲੋਜੀ ਕੰਮ ਨਹੀਂ ਕਰਦੀ ਕਈ ਵਾਰ ਇਸ ਤਕਨਾਲੋਜੀ ਕਰਕੇ ਆਪਸੀ ਰਿਸ਼ਤਿਆਂ ਵਿੱਚ ਵੀ ਬਹੁਤ ਜ਼ਿਆਦਾ ਵਿਗਾੜ ਪਏ ਹਨ